ਮੈਂ ਸੰਪਾਦਨ ਅਤੇ ਸੰਸ਼ੋਧਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲਦੀ ਹਾਂ ਕੁਛ ਵੀ ਲਿਖਣ ਤੋਂ ਪਹਿਲਾਂ ਮੈਂ ਉਸਨੂੰ ਚੰਗੀ ਤਰ੍ਹਾਂ ਸਮਝਦੀ ਹਾਂ ਅ ਸਮਝਦੀ ਹਾਂ ਉਸ ਲਈ ਵਲਾ ਵੱਖ ਵੱਖ ਤਰ੍ਹਾਂ ਉ ਉਸਨੂੰ ਵੱਖ ਵੱਖ ਤਰ੍ਹਾਂ ਨਾਲ ਸੋਚਦੀ ਹਾਂ ਉਸਦੀ ਪਹਿਲਾਂ ਆਪਣੇ ਮਾਇੰਡ ਵਿੱਚ ਸਕਟਸ ਸਟਰਕਚਰ ਬਣਾਉਂਦੀ ਹਾਂ ਉਸ ਤੋਂ ਬਾਅਦ ਹੀ ਉਸਨੂੰ ਮੈਂ ਲਿਖਦੀ ਹਾਂ ਲਿਖਣ ਤੋਂ ਬਾਅਦ ਮੈਂ ਆਪ ਪੜ੍ਹਦੀ ਹਾਂ ਜੇਕਰ ਉਸ ਵਿੱਚ ਕੋਈ ਕਮੀ ਹੁੰਦੀ ਹੈ ਤਾਂ ਮੈਂ ਉਹਦੇ ਵਿੱਚ ਸੰਸ਼ੋਧਨ ਕਰਦੀ ਹਾਂ ਮੈਨੂੰ ਜੇ ਤਾਂ ਵੀ ਜੇਕਰ ਕੁਛ ਵੀ ਕਮੀ ਲੱਗਦੀ ਹੈ ਤਾਂ ਮੈਂ ਆਪਣੇ ਕਿਸੇ ਵੱਡੇ ਤੋਂ ਜਾਂ ਫਿਰ ਮੇਰੇ ਜੋ ਸੀਨੀਅਰ ਨੇ ਉਹਨਾਂ ਤੋਂ ਸੰਸ਼ੋਧਨ ਕਰਵਾਉਂਦੀ ਹਾਂ ਜੇਕਰ ਉਹ ਕਹਿੰ ਉਹ ਦੱਸਦੇ ਹਨ ਕਿ ਇਹ ਬਿਲਕੁਲ ਠੀਕ ਹੈ ਤਾਂ ਹੀ ਉਸਦਾ ਸੰਪਾਦਨ ਕੀਤਾ ਜਾਂਦਾ ਹੈ ਇਸ ਦਾ ਸੰਪਾਦਨ ਕੀਤਾ ਜਾਂਦਾ ਹੈ ਸੰਪਾਦਨ ਕਰਨ ਤੋਂ ਪਹਿਲਾਂ ਵੀ ਉਸਨੂੰ ਪੂਰੀ ਤਰ੍ਹਾਂ ਜਾਂਚਿਆ ਪਰਖਿਆ ਜਾਂਦਾ ਹੈ ਜਾਂਚਿਆ ਪਰਖਿਆ ਜਾਂਦਾ ਹੈ ਜੋ ਵੀ ਅਤੇ ਮੈਂ ਕਹਾਣੀ ਕਵਿਤਾ ਲਿਖਦੀ ਹਾਂ ਉਸ ਜੋ ਵੀ ਮੈਂ ਕਹਾਣੀ ਕਵਿਤਾ ਲਿਖਦੀ ਹਾਂ ਉਸ ਉਸ ਬਾਰੇ ਲਿਖਣ ਤੋਂ ਪਹਿਲਾਂ ਮੈਂ ਸਭ ਕੁਛ ਜਾਂਚਦੀ ਹਾਂ ਪਹਿਲਾਂ ਵੱਖ ਵੱਖ ਕਿਤਾਬਾਂ ਪੜ੍ਹਦੀ ਹਾਂ ਉਹਨਾਂ ਤੋਂ ਅਲੱਗ ਅਲੱਗ ਤਰ੍ਹਾਂ ਦਾ ਮਟੀਰੀਅਲ ਇਕੱਠਾ ਕਰਕੇ ਮੈਂ ਉਸਨੂੰ ਆਪਣੇ ਆਪਣੀ ਰਾਈਟਿੰਗ ਵਿੱਚ ਆਪਣੀ ਰਾਈਟਿੰਗ ਵਿੱਚ ਲਿਖਦੀ ਹਾਂ ਉਸ ਵਿੱਚ ਆਪਣੇ ਵਿਚਾਰ ਵੀ ਪੇਸ਼ ਕਰਦੀ ਹਾਂ ਇਸ ਨਾਲ ਮੇਰਾ ਇਸ ਨਾਲ ਮੇ ਇਸ ਨਾਲ ਮੇਰਾ ਸੋ ਰਾਈਟਿੰਗ ਹੈ ਉਹ ਉਸ ਉਹ ਵੀ ਵਧੀਆ ਹੁੰਦੀ ਹੈ ਆਪਣੀ ਰਾਈਟਿੰਗ ਨੂੰ ਹੋਰ ਵੀ ਵਿਕਸਿਤ ਕਰਨ ਲਈ ਮੈਂ ਅਲੱਗ ਅਲੱਗ ਤਰ੍ਹਾਂ ਦੀਆਂ ਬਹੁਤ ਕਿਤਾਬਾਂ ਪੜ੍ਹਦੀ ਹਾਂ ਆਪਣੇ ਸੀਨੀਅਰਾਂ ਦੀ ਮਦਦ ਲੈਂਦੀ ਹਾਂ ਜਿਸ ਨਾਲ ਮੇਰੀ ਲਿਖਾਵਟ ਹੋਰ ਵੀ ਜ਼ਿਆਦਾ ਵਧੀਆ ਹੋ ਸਕੇ